ਜਿਵੇਂ ਕਿ ਮੈਂ ਪੰਜਾਬ ਤੋਂ ਹਾਂ ਤਾਂ ਉੱਤਰੀ ਭਾਰਤ ਨਾਲ਼ ਸੰਬੰਧ ਰੱਖਦੀ ਹਾਂ ਤਾਂ ਉੱਤਰ ਭਾਰਤ ਦੇ ਜ਼ਿਆਦਾਤਰ ਮੈਨੂੰ ਭੋਜਨ ਪਕਵਾਨ ਜ਼ਿਆਦਾ ਪਸੰਦ ਨੇ ਜਿਵੇਂ ਕਿ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਦਾਲ ਮੱਖਣੀ ਇੱਦਾਂ ਦੀਆਂ ਆਈਟਮਸ ਘਰ ਬਣਿਆ ਹੋਇਆ ਫੂਡ ਸਭ ਤੋਂ ਵਧੀਆ ਲੱਗਦਾ ਹੈ ਠੀਕ ਹੈ ਤਾਂ ਜੇਕਰ ਅਸੀਂ ਦੇਖੀਏ ਕਿ ਦੱਖਣੀ ਭਾਰਤ ਦੀ ਦੱਖਣੀ ਭਾਰਤੀ ਦੇ ਵਿੱਚ ਵੀ ਇਡਲੀ ਡੋਸਾ ਸਾਂਬਰ ਜਿਹੜਾ ਕਿ ਅਸੀਂ ਮਤਲਬ ਮੈਂ ਖਾਣਾ ਪਸੰਦ ਕਰਾਂਗੀ ਤਾਂ ਉਹ ਕਦੇ ਕਦੇ ਜਦੋਂ ਕਿਤੇ ਅਸੀਂ ਰੈਸਟੋਰੈਂਟ 'ਚ ਵਿਜ਼ਿਟ ਕਰਦੇ ਹਾਂ ਤਾਂ ਦੱਖਣੀ ਭਾਰਤੀ ਉੱਤਰੀ ਭਾਰਤੀ ਮਤਲਬ ਆਪਣੇ ਭਾਰਤੀ ਸਾਰੇ ਖਾਣੇ ਹੀ ਖਾਣੇ ਮੈਂ ਪਸੰਦ ਕਰਾਂਗੀ